ਹੈਲੋ ਹਾਂਜੀ ਹਾਂਜੀ ਹਾਂਜੀ ਪਰਮਜੀਤ ਸਿੰਘ ਬੋਲਦਾ ਜੀ ਹਾਂਜੀ ਬੋਲੋ ਅੱਛਾ ਜੀ ਹਾਂ ਜੀ ਹਾਂ ਪਿਆ ਆਪਣਾ ਆਪਦੀ ਪਲਾਟ ਪਿਆ ਜੀ ਇੱਧਰ ਆਪਣਾ ਆਪਣਾ ਜੈਕਰ ਜੈਕਰ ਦੀ ਚੱਕੀ ਕੋਲ ਪਿਆ ਜੀ ਇਹਦਾ ਸਾਈਜ਼ ਹੈਗਾ ਜੀ ਵੀਹ ਬਾਈ ਅੱਸੀ ਹੈ ਜੀ ਅੱਛਾ ਕਿੰਨੀ ਕੁ ਜਗ੍ਹਾ ਚਾਹੀਦੀ ਹੈ ਜੀ ਕਈ ਪਏ ਨੇ ਪਲਾਟ ਆਪਣੇ ਕੋਲ ਚਾਰ ਦਾ ਵੀ ਪਿਆ ਪੰਜ ਦਾ ਪਿਆ ਹਾਂ ਹਾਂ ਪਿਆ ਜੀ ਉਹ ਵੀ ਪਿਆ ਉੱਤੋਂ ਅੱਗੇ ਪਿਆ ਥੋੜ੍ਹਾ ਜਿਹਾ ਜੀ ਰੇ ਰੇਟ ਤਾਂ ਜੀ ਹੁਣ ਉੱਥੇ ਢਾਈ ਲੱਖ ਫੁੱਟ ਵਿਕਿਆ ਜੀ ਹਾਂ ਹਾਂ ਹਾਂ ਹਾਂ ਕੋਈ ਨਹੀਂ ਤੁਹਾਨੂੰ ਜੇ ਫਿੱਟ ਹੈ ਕੋਈ ਨਹੀਂ ਕਰ ਲਾਂਗੇ ਜੀ ਰੇਟ ਤਾਂ ਹੁਣ ਅਸੀਂ ਫਿਰ ਕਿਤੇ ਤਾਂ ਅਗਲਾ ਆਪਦੀ ਚੀਜ਼ ਦਾ ਰੇਟ ਮੰਗਦਾ ਹੀ ਹੈ ਜੀ ਹਾਂ ਹਾਂ ਹਾਂ ਉੱਧਰ ਵੀ ਦਵਾ ਦਿਆਂਗੇ ਜੀ ਉੱਧਰ ਦਵਾ ਦਿਆਂਗੇ ਜੀ ਪਿੱਛੇ ਉੱਧਰ ਦੇ ਦਵਾ ਦਿਆਂਗੇ ਪਿੱਛੇ ਐਟਮਾਂ ਤੁਹਾਨੂੰ ਭਾਅ ਨਾਲ ਕਿੰਨੇ ਕੁ ਪੈਸੇ ਲਾਉਣੇ ਤੁਸੀਂ ਅੱਛਾ ਅੱਛਾ ਪੈਸੇ ਕਿੰਨੇ ਕੁ ਲਾਉਣੇ ਤੁਸੀਂ ਠੀਕ ਹੈ ਠੀਕ ਹੈ ਮਕਾਨ ਹੀ ਪਾਉਣਾ ਹੋਊ ਤੁਸੀਂ ਤਾਂ ਕੋਈ ਗੱਲ ਨਹੀਂ ਦਵਾ ਦਿਆਂਗੇ ਜੀ ਵਾਧੂ ਪਏ ਨੇ ਪਲਾਟ ਕਦੋਂ ਆਉਂਗੇ ਤੁਸੀਂ ਡਰੈੱਸ ਤਾਂ ਆਪਣਾ ਇੱਧਰ ਆ ਜੀ ਪਿੰਡ 'ਚ ਆ ਮਕਾਨ ਆਪਣਾ ਤਾਂ ਜੈਕਰ ਦੀ ਚੱਕੀ ਕੋਲ ਵਾਰਡ ਨੰਬਰ ਸਤਾਰ੍ਹਾਂ ਜੀ ਹਾਂਜੀ ਹਾਂ ਹਾਂ ਅੱਛਾ ਅੱਛਾ ਹਾਂ ਤੁਹਾਨੂੰ ਨਾਲੇ ਆ ਜਿਓ ਤੁਸੀਂ ਨਾਲੇ ਤੁਹਾਨੂੰ ਮੈਂ ਪਲਾਟ ਦਿਖਾ ਦੂੰਗਾ ਹਾਂ ਹਾਂ ਠੀਕ ਹੈ ਜੀ ਓਕੇ